ਪੰਜਾਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਵੇਂ ਕਿ ਚੋਰੀ ਡਕੈਤੀ ਆਦਿ ਅਤੇ ਇਹ ਇੱਕ ਮੌਜੂਦਾ ਘਟਨਾ ਜਿਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਇੱਕ ਚੋਰੀ ਡਕੈਤੀ ਜੋ ਬੈਂਕ ਵਿੱਚ ਲ ਕਰੀ ਗਈ ਹੈ ਉਸ ਵਿੱਚ ਇੱਕ ਔਰਤ ਦਾ ਮੇਨ ਹੱਥ ਸੀ ਇੱਕ ਮੇਨ ਲੀਡਰ ਸੀ ਔਰਤ ਅਤੇ ਉਹਨੇ ਪੰਜ ਜਾਣਿਆਂ ਸਮੇਤ ਉੱਥੇ ਲੁਧਿਆਣੇ ਦੇ ਵਿੱਚ ਇੱਕ ਬੈਂਕ ਦੇ ਵਿੱਚ ਚੋਰੀ ਕਰਕੇ ਵੈਨ ਨੂੰ ਜਿਹੜਾ ਹੈਗਾ ਬੰਦੀ ਬਣਾ ਕੇ ਉਹਨਾਂ ਨੂੰ ਲੁੱਟ ਕੀਤੀ ਹੈ ਅਤੇ ਬਾਅਦ ਦੇ ਵਿੱਚ ਉਹ ਉੱਤਰਾਖੰਡ ਦੀ ਪਹਾੜੀਆਂ ਦੇ ਵਿੱਚ ਛੁਪ ਗਏ ਸਨ ਜਿੱਥੇ ਉਹਨਾਂ ਨੂੰ ਲੱਭਿਆ ਗਿਆ ਅਤੇ ਉਹਨਾਂ ਨੂੰ ਸਖਤ ਕਾਰਵਾਈ ਦੌਰਾਨ ਐਸਐਸਪੀ ਦੁਆਰਾ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ